ਮੈਂ ਖ਼ਬਰਾਂ ਰੋਜ਼ ਪੜ੍ਹਦੀ ਨਹੀਂ ਹਾਂ ਪਰ ਜਦੋਂ ਵੀ ਮੈਨੂੰ ਵਕਤ ਮਿਲਦਾ ਹੈ ਜਾਂ ਕੋਈ ਵੱਡੀ ਘਟਨਾ ਵਾਪਰਦੀ ਹੈ ਤਾਂ ਭਰੋਸੇਯੋਗ ਸਰੋਤਾਂ ਤੋਂ ਖ਼ਬਰਾਂ ਜਾਂਚ ਲੈਂਦੀ ਹਾਂ ਮੈਂ ਖ਼ਬਰਾਂ ਲਈ ਵੈਬਸਾਈਟਾਂ ਯੂਟੀਊਬ ਅਤੇ ਕੁਝ ਸਮੇਂ ਸਮੇਂ 'ਤੇ ਟੀਜ਼ੀ ਟੀ ਵੀ ਨਿਊਜ਼ ਵੀ ਵੇਖਦੀ ਹਾਂ ਪਰ ਸ਼ੋਸ਼ਲ ਮੀਡੀਆ 'ਤੇ ਆਉਣ ਵਾਲੀਆਂ ਹਰ ਖ਼ਬਰ 'ਤੇ ਤੁਰੰਤ ਵਿਸ਼ਵਾਸ ਨਹੀਂ ਕਰਦੀ ਹਾਂ ਮੈਨੂੰ ਟੈਕਨੋਲੋਜੀ ਵਿਗਿਆਨ ਅਤੇ ਸਮਾਜ ਮੁੱਦਿਆਂ ਬਾਰੇ ਖ਼ਬਰਾਂ ਦੇਖਣੀਆਂ ਪਸੰਦ ਹਨ ਇਹਨਾਂ ਤੋਂ ਇਲਾਵਾ ਜਦੋਂ ਕਦੇ ਦੇਸ਼ ਵਿਦੇਸ਼ ਦੀਆਂ ਮੁੱਖ ਘਟਨਾਵਾਂ ਨਵੀਆਂ ਪੋਲਸੀਆਂ ਜਾਂ ਵੱਡੀਆਂ ਰਾਜਨੀਤਿਕ ਤਬਦੀਲੀਆਂ ਹੁੰਦੀਆਂ ਹਨ ਤਾਂ ਉਹਨਾਂ ਬਾਰੇ ਵੀ ਜਾਣਕਾਰੀ ਲੈਣੀ ਚੰਗੀ ਲੱਗਦੀ ਹੈ ਪਰ ਨਕਰਾਤਮਕ ਅਤੇ ਬੇਵਜਾਹ ਸਨਸਨੀਖੇਜ਼ ਖ਼ਬਰਾਂ ਤੋਂ ਦੂਰ ਰਹਿਣਾ ਪਸੰਦ ਕਰਦੀ ਹਾਂ ਧੰਨਵਾਦ